ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਮੈਂ ਕਿਹਾ ਅੰਮ੍ਰਿਤਸਰ ਤਾਂ ਆਪਾਂ ਘੁੰਮ ਆਏ ਹਾਂ ਹੁਣ ਤੁਸੀਂ ਅੱਗੇ ਕਿੱਥੇ ਲੈ ਕੇ ਜਾਓਗੇ ਸਾਨੂੰ ਅੱਛਾ ਕੀ ਖ਼ਾਸੀਅਤ ਹੈ ਇੱਥੇ ਅੱਛਾ ਅੱਛਾ ਅੱਛਾ ਅੱਛਾ ਇੱਥੇ ਦਾ ਫਿਰ ਕੀ ਹਿਸਾਬ ਕਿਤਾਬ ਹੈ ਟਿਕਟ ਵਗੈਰਾ ਦਾ ਅੱਛਾ ਅੱਛਾ ਤਾਂ ਤੁਸੀਂ ਫਿਰ ਸਾਨੂੰ ਲੈ ਕੇ ਚਲੋਗੇ ਅੱਛਾ ਕੋਈ ਗੱਲ ਨਹੀਂ ਚੱਲ ਪੈਂਦੇ ਆਪਾਂ ਫਿਰ ਚਲੋ